ਪੈਟ੍ਰੋਲ ਦੀਆਂ ਵਧਦੀਆਂ ਕੀਮਤਾਂ ਨੇ ਸਾਡੀ ਬਾਈਕਿੰਗ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਕਿਉਂਕਿ ਪੈਟ੍ਰੋਲ ਦੀਆਂ ਕੀਮਤਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧਣ ਕਰਕੇ ਪੈ ਪੈਸੇ ਪੈਸੇ ਦਾ ਬਹੁਤ ਖਰਚਾ ਹੋ ਰਿਹਾ ਹੈ ਇਸੇ ਕਰਕੇ ਪੈਟ੍ਰੋਲ ਦੀਆਂ ਵਧੀਆਂ ਕੀਮਤਾਂ ਕਰਕੇ ਸਾਡੀ ਬਾਈਕਿੰਗ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਗਿਆ ਹੈ ਆਮ ਬਾਲਣ ਦੀ ਜ਼ਿਆਦਾ ਵਰਤੋਂ ਵਾਤਾਵਰਨ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਕਿਉਂਕਿ ਬਾਲਣ ਬਾਲਣ ਬਾਲਣ ਬਾਲਣ ਬਾਲਣ ਵੇਲੇ ਬਹੁਤ ਸਾਰੀਆਂ ਗੈਸਾਂ ਇਸ ਵਿੱਚੋਂ ਨਿਕਲਦੀਆਂ ਹਨ ਧੂੰਏਂ ਵਿੱਚੋਂ ਨਿਕਲਦੀਆਂ ਹਨ ਜਿਹੜਾ ਕਿ ਸਾਡੇ ਵਾਤਾਵਰਨ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਇਹਦੇ ਵਿੱਚੋਂ ਬਹੁਤ ਸਾਰੀਆਂ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ ਕਾਰ ਕਲੋਰੋਫਲੋਰੋਕਾਰਬਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੈਸਾਂ ਬਹਾਰ ਨਿਕਲਦੀਆਂ ਹਨ ਜਿਹੜੀਆਂ ਕਿ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਇਹਨਾਂ ਇਹਨਾਂ ਕਾਰਨ ਇਸ ਬਾਲਣ ਵਿੱਚੋਂ ਨਿਕਲਣ ਵਾਲਾ ਧੂੰਆਂ ਧੂੰਏਂ ਦੇ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਇਸੇ ਕਰਕੇ ਜਿਹੜਾ ਬਾਲਣ ਹੈ ਦੀ ਜ਼ਿਆਦਾ ਵਰਤੋਂ ਕਾਰਨ ਜ਼ਿਆਦਾ ਵਰਤੋਂ ਜ਼ਿਆਦਾ ਵਰਤੋਂ ਕਰਨਾ ਵਾਤਾਵਰਣ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਇਸੇ ਕਰਕੇ ਸਾਨੂੰ ਵਾਤਾਵਰਨ ਵਾਤਾਵਰਨ ਨੂੰ ਸਾਫ਼ ਸ਼ੁੱਧ ਰੱਖਣ ਲਈ ਬਾਲਣ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਜਿੰਨਾ ਹੋ ਸਕੇ ਜਿੰਨਾ ਜਿੰਨਾ ਜ਼ਿਆਦਾ ਹੋ ਸਕੇ ਸਾਨੂੰ ਟਰੈਵਲ ਟਰੈਵਲ ਪੈਦਲ ਚੱਲ ਕੇ ਜਾਂ ਫਿਰ ਸਾਈਕਲਿੰਗ ਥਰੂ ਕਰਨਾ ਚਾਹੀਦਾ ਹੈ ਪਰ ਪਰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਦੀ ਬਾਲਣ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ